ਬਾਈਕਿੰਗ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਸ਼ੌਂਕ ਸੀਗਾ ਮੈਂ ਹਮੇਸ਼ਾਂ ਹੀ ਕਿਸੇ ਨਾ ਕਿਸੇ ਦੀ ਬਾਈਕ ਲੈ ਕੇ ਚਲਾਉਣ ਦੀ ਕੋਸ਼ਿਸ਼ ਕਰਦਾ ਸੀ ਕਿਉਂਕਿ ਮੈਨੂੰ ਬਹੁਤ ਹੀ ਬਾਈਕਿੰਗ ਦਾ ਸ਼ੌਂਕ ਸੀ ਬਟ ਜਦੋਂ ਮੇਰੇ ਗ੍ਰੈਜੂਏਸ਼ਨ ਦੇ ਪੇਪਰ ਖਤਮ ਹੋਏ ਤਾਂ ਉਸ ਦੇ ਰਿਜ਼ਲਟ ਆਉਣ ਤੋਂ ਬਾਅਦ ਮੈਂ ਅਤੇ ਮੇਰੇ ਦੋਸਤ ਨੇ ਲੇਹ ਲਦਾਖ ਜਾਣ ਦਾ ਪਲੈਨ ਬਣਾਇਆ ਅਸੀਂ ਦੋਨੋਂ ਇੱਕ ਹੀ ਬਾਈਕ 'ਤੇ ਨਿਕਲ ਗਏ ਅਤੇ ਲਾਈਫ ਨੂੰ ਪੂਰਾ ਇੰਜੋਏ ਕੀਤਾ ਅਸੀਂ ਹਰ ਜਗ੍ਹਾ ਹਰ ਹਰ ਜਗ੍ਹਾ ਰੁਕ ਕੇ ਵਿਊ ਨੂੰ ਇਨਜੋਏ ਕੀਤਾ ਬਹੁਤ ਹੀ ਫੋਟੋਆਂ ਖਿੱਚੀਆਂ ਵੀਡੀਓ ਬਣਾਈਆਂ ਅਤੇ ਅਸੀਂ ਆਪਣਾ ਕੱਪੜੇ ਅਤੇ ਖਾਣ ਪੀਣ ਦਾ ਸਾਰਾ ਸਮਾਨ ਨਾਲ ਹੀ ਲੈ ਕੇ ਗਏ ਸੀਗੇ ਸਾਨੂੰ ਜਿੱਥੇ ਵੀ ਬਹੁਤ ਵਧੀਆ ਨਜ਼ਾਰਾ ਦਿਖਿਆ ਉੱਥੇ ਰੁਕ ਕੇ ਅਸੀਂ ਟੈਂਟ ਲਗਾ ਕੇ ਰੁਕੇ ਅਸੀਂ ਕੋਈ ਹੋਟਲ ਵਗੈਰਾ ਬੁੱਕ ਨਹੀਂ ਕੀਤਾ ਹਰ ਜਗ੍ਹਾ ਦਾ ਪੂਰਾ ਹੀ ਨਜ਼ਾਰਾ ਇੰਨਜੋਏ ਕੀਤਾ ਵੱਖਰੇ ਵੱਖਰੇ ਢਾਬਿਆਂ 'ਤੇ ਜਾ ਕੇ ਕੁਛ ਖਾਧਾ ਪੀਤਾ ਹੋਰ ਵੀ ਸਾਨੂੰ ਕੁਛ ਵਧੀਆ ਜਗ੍ਹਾ ਲੱਗੀ ਉੱਥੇ ਰੁਕ ਕੇ ਫੋਟੋਆਂ ਖਿਚੀਆਂ ਕੋਈ ਵਧੀਆ ਚੀਜ਼ ਲੱਗੀ ਉਹ ਰੁਕ ਕੇ ਖਾਧੀ ਟਰਾਏ ਕੀਤੀ ਇਸ ਲਈ ਅਸੀਂ ਆਪਣੀ ਟਰਿੱਪ ਨੂੰ ਬਹੁਤ ਹੀ ਇੰਜੋਏ ਕੀਤਾ ਅਤੇ ਮੈਂ ਬਾਈਕਿੰਗ ਨੂੰ ਬਹੁਤ ਹੀ ਇੰਨਜੋਏ ਕਰਦਾ ਹਾਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ ਆਪਣੇ ਦੋਸਤ ਨਾਲ ਬਾਈਕਿੰਗ 'ਤੇ ਅਲੱਗ ਅਲੱਗ ਜਗ੍ਹਾਵਾਂ 'ਤੇ ਨਿਕਲ ਜਾਂਦਾ ਹਾਂ ਅਤੇ ਹਰ ਜਗ੍ਹਾ ਨੂੰ ਇੰਨਜੋਏ ਕਰਦਾ ਹਾਂ